ਦੇਖੋ ਜੀ ਸਾਰਿਆਂ ਨੂੰ ਆਪਣੀ ਆਪਣੀ ਬੋਲੀ 'ਤੇ ਮਾਣ ਹੁੰਦਾ ਹੈ ਜਿਸ ਤਰ੍ਹਾਂ ਦੇਖਦੇ ਅਸੀਂ ਕਿ ਪੰਜਾਬ ਵਿੱਚ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਕਿ ਪੰਜਾਬੀ ਬੋਲੀ ਸਾਡੀ ਮਾਂ ਆ ਅਸੀਂ ਦੇਖਿਆ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ 'ਚ ਸ਼ੁਰੂ ਤੋਂ ਹੀ ਪਾ ਦਿੰਦੇ ਆ ਉਹਨਾਂ ਨੂੰ ਪੰਜਾਬੀ ਜਾ ਕੇ ਵ ਵੱਡੀਆਂ ਕਲਾਸਾਂ 'ਚ ਲੱਗਦੀ ਹੈ ਜਾਂ ਕੁਛ ਤਿ ਤਿੰਨ ਚਾਰ ਸਾਲ ਬਾਅਦ ਹੀ ਲੱਗਦੀ ਬੱਚਿਆਂ ਨੂੰ ਪੰਜਾਬੀ ਜਦਕਿ ਪਹਿਲਾਂ ਕੀ ਟਾਈਮ ਸੀਗਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਸੀ ਸਕੂਲ ਜਾਂਦੇ ਸੀ ਅਤੇ ਉਹਨਾਂ ਨੂੰ ਪੰਜਾਬੀ ਹੀ ਸਿਖਾਈ ਜਾਂਦੀ ਊੜਾ ਆੜਾ ਉਥੋਂ ਹੀ ਸ਼ੁਰੂ ਹੁੰਦਾ ਸੀ ਉਹਨਾਂ ਦਾ ਅੱਜ ਕੱਲ੍ਹ ਏ ਬੀ ਸੀ ਸ਼ੁਰੂ ਹੋ ਗਈ ਹੈ ਬੱਚਿਆਂ ਨੂੰ ਪੰਜਾਬੀ ਨਾ ਆਉਣ ਕਰਕੇ ਦੇਖੋ ਨਾ ਬਾਹਰ ਜਾਂਦੇ ਬੱਚੇ ਇੰਗਲਿਸ਼ ਮੀਡੀਅਮ ਹੋ ਗਿਆ ਆਈਲੈਟਸ ਹੁੰਦੀ ਹੈ ਇੰਗਲਿਸ਼ ਮੀਡੀਅਮ 'ਚ ਹੁੰਦੀ ਹੈ ਉੱਥੇ ਜਾਂਦੇ ਫੋਰਨ ਕੰਟਰੀ 'ਚ ਜਾਂਦੇ ਆ ਬੱਚੇ ਆਪਣੀ ਪੰਜਾਬੀ ਬੋਲੀ ਭੁੱਲੇ ਹੁੰਦੇ ਆ ਪੰਜਾਬੀ ਵੀ ਚਲੋ ਬੋਲਦਾ ਜੇ ਕੋਈ ਲੈਂਦਾ ਹੀ ਲਿਖਣੀ ਤਾਂ ਉਹਨਾਂ ਨੂੰ ਆਉਂਦੀ ਹੋਈ ਨਹੀਂ ਨਾ ਬਿਲਕੁਲ ਵੀ ਇੱਥੋਂ ਹੋਰ ਕਿਸੇ ਦੀ ਕੀ ਗੱਲ ਕਰਨੀ ਆਪਣੇ ਘਰ 'ਚ ਦੇਖ ਲਓ ਮੇਰਾ ਬੇਟਾ ਹੀ ਆ ਉਹਨੂੰ ਉਹਨੂੰ ਪੰਜਾਬੀ ਬਿਲਕੁਲ ਨਹੀਂ ਲਿਖਣੀ ਆਉਂਦੀ ਬੋਲਣ ਲਈ ਵੀ ਉਹਨੂੰ ਕਹਿ ਦਿਓ ਬੋਲ ਤਾਂ ਚਲੋ ਲਏਗਾ ਲਿਖ ਨਹੀਂ ਸਕੇਗਾ ਪੜ੍ਹ ਨਹੀਂ ਸਕੇਗਾ ਕਿ ਪੰਜਾਬੀ 'ਚ ਕੀ ਲਿਖਿਆ ਉਹ ਕ ਥੋੜ੍ਹੇ ਟਾਈਮ ਲਈ ਪੜ੍ਹਾਈ ਉਸ ਤੋਂ ਬਾਅਦ ਅੱਗੋਂ ਕਹਿੰਦੇ ਏਟਥ ਨਾਈਨ 'ਚ ਆ ਗਏ ਜੀ ਪੜ੍ਹਾਈ ਜੇ ਕਿਸੇ ਨੇ ਲਗਵਾਉਣੀ ਤਾਂ ਲਗਵਾਓ ਨਹੀਂ ਤਾਂ ਨਾ ਲਗਵਾਓ ਪੇਪਰ ਵੀ ਦਿੰਦੇ ਆ ਬੱਸੀ ਮਸੀ ਜਦੋਂ ਕਿ ਮੇਰੇ ਹਿਸਾਬ ਨਾਲ ਪੰਜਾਬੀ ਹਰ ਇੱਕ ਦੇਸ਼ ਨੂੰ ਆਪਣੀ ਆਪਣੀ ਬੋਲੀ ਅੱਛੀ ਲੱਗਦੀ ਆ ਹਰ ਇਸ ਵਿੱਚ ਪੰ ਜੇ ਅਸੀਂ ਪੰਜਾਬ 'ਚ ਰਹਿੰਦੇ ਹਾਂ ਤਾਂ ਮੇਰੇ ਹਿਸਾਬ ਨਾਲ ਪੰਜਾਬੀ ਬੋਲੀ ਸ ਨੂੰ ਬੱਚਿਆਂ ਨੂੰ ਜ਼ਰੂਰ ਸਿਖਾਉਣੀ ਚਾਹੀਦੀ ਹੈ ਅਤੇ ਇਹ ਪੰਜਾਬੀ ਹਰ ਹਰ ਮਤਲਬ ਪੜ੍ਹਾਈ ਜਿੰਨੀ ਦੇਰ ਤੱਕ ਬ ਬੱਚਾ ਪੰਜਾਬ 'ਚ ਪੜ੍ਹ ਰਿਹਾ ਪੰਜਾਬੀ ਕੰਪਰਸਰੀ ਹੋਣੀ ਹੀ ਚਾਹੀਦੀ ਹੈ ਬੱਚਿਆਂ ਨੂੰ